ਜਿਹੜੀ ਚੀਜ਼ ਦੇ ਲਾਭ ਹੁੰਦੇ ਉਸ ਚੀਜ਼ ਦੇ ਦੇ ਨੁਕਸਾਨ ਵੀ ਹੁੰਦੇ ਜਿਵੇਂ ਕਿ ਟਕਨੌਲਜੀ ਜਿਵੇਂ ਕਿ ਸੈਕਲ ਸਗੋਂ ਕਿ ਲੋਕ ਸੈਕਲ 'ਤੇ ਜਾਂਦੇ ਸੀਗੇ ਤਾਂ ਉਨ੍ਹਾਂ ਨੂੰ ਸੈਕਲ ਜਾਂਦੇ ਉਨ੍ਹਾਂ ਦੀ ਕਸਰਤ ਹੁੰਦੀ ਸੀਗੀ ਉਨ੍ਹਾਂ ਦੀ ਲੱਤਾਂ ਬਾਹਾਂ ਠੀਕ ਰਹਿੰਦੀਆਂ ਸੀਗੀਆਂ ਅਤੇ ਅਤੇ ਲੋਕ ਪਤਲੇ ਰਹਿੰਦੇ ਸੀਗੇ ਜਦੋਂ ਤੋਂ ਇਹ ਟੂ ਵੀਲਰ ਫੌਰ ਵੀਲਰ ਆ ਗਏ ਲੋਕ ਮੋਟੇ ਹੋਣ ਲੱਗ ਪਏ ਬਿਮਾਰੀਆਂ ਚਿਬੜਨ ਲੱਗ ਪਈਆਂ ਲੋਕ ਇਹ ਮਸ਼ੀਨ ਦਾ ਸਹਾਰਾ ਲੈਂਦੇ ਹਨ ਅਤੇ ਜਿੰਮ ਦਾ ਸਹਾਰਾ ਲੈਂਦੇ ਕਸਰਤ ਦਾ ਸਹਾਰਾ ਲੈਂਦੇ ਬਾਕੀ ਮਸ਼ੀਨਾਂ ਜਿਹੜੇ ਕੰਮ ਲੋਕ ਅੱਗੇ ਹੱਥਾਂ ਨਾਲ ਕਰਦੇ ਸੀਗੇ ਉਹ ਮਸ਼ੀਨਾਂ ਨਾਲ ਕੰਮ ਕਰਨ ਲੱਗ ਪਏ ਆ ਲੋਕਾਂ ਵਿੱਚ ਬੇਰੁਜ਼ਗਾਰੀ ਜ਼ਿਆਦਾ ਹੋ ਗਈ ਅਤੇ ਬਾਕੀ ਫੋਨ ਬੱਚੇ ਨੂੰ ਕੰਮ ਲੋਕ ਔ ਸਕੂਲ ਦੇ ਟੀਚਰ ਔਨਲਾਈਨ ਕੰਮ ਦੇਣ ਲੱਗ ਪਏ ਬੱਚੇ ਸਕੂਲ ਦਾ ਕੰਮ ਘੱਟ ਕਰਦੇ ਹਨ ਅਤੇ ਗੇਮਾਂ ਜ਼ਿਆਦਾ ਖੇਡਦੇ ਹਨ ਜਿਸ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਅਤੇ ਇਸ ਨਾਲ ਲੋਕਾਂ ਉਨ੍ਹਾਂ ਦੀ ਸਿਹਤ 'ਤੇ ਵੀ ਬੜਾ ਪ੍ਰਭਾਵ ਪੈਂਦਾ ਹੈ